ਜਿਵੇਂ ਕਿ ਸਾਨੂੰ ਪਤਾ ਹੀ ਹੈ ਅੱਜ ਕੱਲ ਦਾ ਦੌਰ ਤਕ ਤਕਨਾਲੋਜੀ ਦਾ ਦੌਰ ਹੈ ਅੱਜ ਕੱਲ ਸਵੇਰ ਜੋ ਅਸੀਂ ਜਿਹੜਾ ਮਰਜ਼ੀ ਕੰਮ ਕਰ ਲਈਏ ਹਰ ਕੰਮ ਵਿੱਚ ਕਿਤੇ ਨਾ ਕਿਤੇ ਟੈਕਨੋਲੋਜੀ ਆ ਹੀ ਜਾਂਦੀ ਹੈ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਹਰ ਇੱਕ ਕਿਰਿਆ ਵਿੱਚ ਹਰ ਇੱਕ ਪ੍ਰਕਿਰਿਆ ਵਿੱਚ ਕਿਤੇ ਨਾ ਕਿਤੇ ਟੈਕਨੋਲੋਜੀ ਦਾ ਪ੍ਰਭਾਵ ਪੈਂਦਾ ਹੀ ਹ ਅਸੀਂ ਮੰਨਦੇ ਹਾਂ ਕਿ ਟੈਕਨੋਲੋਜੀ ਨੇ ਸਾਨੂੰ ਬਹੁਤ ਹੀ ਫਾਇਦੇ ਪਹੁੰਚਾਏ ਹਨ ਪਰ ਇਸ ਤੇ ਕਾਫੀ ਨੁਕਸਾਨ ਵੀ ਹਨ ਪਹਿਲੀ ਗੱਲ ਤਾਂ ਇਹ ਸਾਡੇ ਸਰੀਰ ਨੂੰ ਨੁਕਸਾਨ ਹ ਸਾਡੇ ਮਾਨਸਿਕ ਤੌਰ ਤੇ ਸਾਨੂੰ ਨੁਕਸਾਨ ਪੈਂਦਾ ਹੈ ਸਭ ਤੋਂ ਵੱਡਾ ਨੁਕਸਾਨ ਜੋ ਮੈਨੂੰ ਲੱਗ ਰਿਹਾ ਹੈ ਅੱਜ ਕੱਲ ਦੇ ਦੁਨੀਆ ਵਿੱਚ ਅਸੀਂ ਟੈਕਨੋਲੋਜੀ ਕਰਕੇ ਅਸੀਂ ਪਰਿਵਾਰ ਤੋਂ ਵਿਛੋੜਾ ਪਾ ਰਹੇ ਹਾਂ ਅਸੀਂ ਪਰਿਵਾਰ ਤੋਂ ਆਪਣੇ ਦੂਰ ਹੋ ਰਹੇ ਹਾਂ ਅੱਜ ਕੱਲ ਅਸੀਂ ਦੇਖਦੇ ਹੀ ਹਾਂ ਪਹਿਲਾ ਪਹਿਲਾਂ ਜਿਵੇਂ ਬੱਚੇ ਕਰਦੇ ਸੀਗੇ ਬੱਚੇ ਜਦੋਂ ਪੜ੍ਹ ਕੇ ਆਉਂਦੇ ਸੀਗੇ ਆਪਣੇ ਸਕੂਲੋਂ ਘਰ ਆਉਂਦੇ ਸੀਗੇ ਰਾਤੇ ਸੌਣ ਵੇਲੇ ਖਾਣੇ ਤੋਂ ਪਹਿਲਾਂ ਖਾਣੇ ਤੋਂ ਬਾਅਦ ਸਾਰਾ ਪਰਿਵਾਰ ਇਕੱਠਾ ਬਹਿ ਕੇ ਰੋਟੀ ਖਾਂਦੇ ਸੀਗੇ ਆਪਸ ਚ ਗੱਲਾਂ ਕਰਦੇ ਸੀਗੇ ਵੱਡੇ ਬੱਚੇ ਛੋਟੇ ਬੱਚੇ ਵੱਡੇ ਬੱਚੇ ਬਜ਼ੁਰਗ ਸਾਰੇ ਸਾਡੇ ਮਾਂ ਬਾਪ ਅਸੀਂ ਆਪਸ ਚ ਇਕੱਠੇ ਬਹਿ ਕੇ ਗੱਲਾਂ ਕਰਦੇ ਸੀ ਪਰ ਅੱਜ ਕੱਲ ਕੀ ਹੋ ਰਿਹਾ ਬੱਚੇ ਰੋਟੀ ਖਾਂਦੇ ਆ ਬੱਚਾ ਆਪਣੇ ਫੋਨ ਤੇ ਲੱਗਾ ਮਾਂ ਬਾਪ ਆਪਣੇ ਫੋਨ ਤੇ ਲੱਗੇ ਆ ਬਜ਼ੁਰਗਾਂ ਨੂੰ ਕੋਈ ਪੁੱਛਦਾ ਨਹੀਂ ਇਸ ਨਾਲ ਕੀ ਹੋ ਰਿਹਾ ਇਸ ਨਾਲ ਪਰਿਵਾਰਕ ਸਾਂਝ ਟੁੱਟਦੀ ਜਾ ਟੁੱਟਦੀ ਜਾ ਰਹੀ ਆ ਪਰਿਵਾਰ ਵਿੱਚ ਸਾਂਝਾ ਘੱਟ ਹੋ ਰਹੀਆਂ ਜਿਸ ਨਾਲ ਪਰਿਵਾਰ ਛੋਟੇ ਹੋ ਰਹੇ ਆ ਹਰ ਇੱਕ ਆਪਣਾ ਪਰਿਵਾਰ ਵੱਖਰਾ ਰਹਿ ਰਿਹਾ ਅੱਜ ਕੱਲ ਚਾਰ ਬੱਚੇ ਕਿਤੇ ਨਾ ਕਿਤੇ ਬੈਠੇ ਹੁੰਦੇ ਹਨ ਜਾਂ ਚਾਰ ਕੋਈ ਵੀ ਜੀਅ ਬੈਠੇ ਹੁੰਦੇ ਹਨ ਉਹ ਆਪਸ ਚ ਗੱਲ ਹੀ ਨਹੀਂ ਕਰਦੇ ਬਸ ਆਪਣੇ ਫੋਨ ਤੇ ਟਿਕ ਟਿਕ ਲੱਗੇ ਰਹਿੰਦੇ ਹਨ ਨਾ ਕਿਸੇ ਨੇ ਗੱਲ ਕਰਦੇ ਹਨ ਨਾ ਪੁੱਛਦੇ ਹਨ ਨਾ ਕੁਝ ਕਰਦੇ ਹਨ ਇਸ ਨਾਲ ਸਾਡੇ ਆਪਸ ਚ ਵੀ ਸਮਾਜਿਕ ਤੌਰ ਤੇ ਅਸੀਂ ਟੁੱਟ ਟੁੱਟਦੇ ਜਾ ਰਹੇ ਹਾਂ ਤੇ ਆਪਣੇ ਆਪ ਵਿੱਚ ਹੀ ਸਮਾਦੇ ਜਾ ਰਹੇ ਹਾਂ ਸਾਨੂੰ ਇਸ ਨੂੰ ਰੋਕਣਾ ਚਾਹੀਦਾ ਹੈ ਸਾਨੂੰ ਸਮਝਣਾ ਚਾਹੀਦਾ ਹੈ ਕਿ ਟੈਕਨੋਲੋਜੀ ਦੇ ਜਿੱਥੇ ਸਾਨੂੰ ਫਾਇਦੇ ਪਹੁੰਚਾ ਰਹੀ ਹੈ ਇਸ ਦੇ ਨੁਕਸਾਨ ਵੀ ਹਨ ਸਾਨੂੰ ਇਸ ਦੇ ਨੁਕਸਾਨ ਆਪ ਹੀ ਸਮਝ ਕੇ ਇਸ ਨੂੰ ਸਹੀ ਤਰੀਕੇ ਨਾਲ ਇਸਦੀ ਵਰਤੋਂ ਕਰਨੀ ਚਾਹੀਦੀ ਹੈ